ਹੈਲੋ ਮੈਂ ਸੁਖਵੰਤ ਸਿੰਘ ਬੋਲ ਰਿਹਾ ਜੀ ਤੁਸੀਂ ਪ੍ਰੇਮ ਢਾਬੇ ਤੋਂ ਬੋਲ ਰਹੇ ਹੈ ਮੈਂ ਸਵੇਰੇ ਨੌ ਵਜੇ ਲੰਚ ਆਡਰ ਕਰਿਆ ਸੀ ਜੀ ਉਹਦੇ 'ਚ ਦਾਲ ਮੱਖਣੀ ਸ਼ਾਹੀ ਪਨੀਰ ਕੜਾਹੀ ਪਨੀਰ ਅਤੇ ਮਿਕਸ ਸਬਜ਼ੀ ਆਡਰ ਕਰੀ ਸੀ ਕੀ ਤੁਸੀਂ ਜੀ ਸਾਨੂੰ ਉਹਦੇ ਨਾਲ ਚਟਣੀ ਸਲਾਦ ਰਾਇਤਾ ਅਚਾਰ ਵਗੈਰਾ ਸਾਨੂੰ ਨਾਲ ਦੇਵੋਗੇ ਤਾਂ ਕਿੰਨੀ ਕੁਆਲਟੀ ਵਿੱਚ ਦੇਵੋਗੇ ਜਿਹੜੀਆਂ ਅਸੀਂ ਚਾਰ ਪਲੇਟਾਂ ਆਡਰ ਕਰੀਆਂ ਜੀ ਇਹ ਸਾਨੂੰ ਕਿਤਨੀ ਕੁਆਲਟੀ 'ਚ ਦਓਂਗੇ ਜਿਹੜਾ ਅਸੀਂ ਐਸਟਰਾ ਇਹ ਸਾਨੂੰ ਚੀਜ਼ਾਂ ਚਾਹੀਦੀਆਂ ਨੇ ਕੀ ਤੁਸੀਂ ਇਹਦੇ ਕੋਈ ਪੈਸੇ ਲੈਣਗੇ ਰਾਇਤਾ ਵਗੈਰਾ ਜਿਹੜਾ ਅਸੀਂ ਨਾਲ ਲੈਣਾ ਜੀ ਕੀ ਇਹਦੇ ਐਸਟਰਾ ਪੈਸੇ ਲਏ ਜਾਣਗੇ ਜੇ ਲਏ ਜਾਣਗੇ ਤਾਂ ਕਿੰਨੇ ਲਏ ਜਾਣਗੇ ਕਿੰਨੇ ਟੈਮ ਤੱਕ ਸਾਡਾ ਆਡਰ ਪਹੁੰਚ ਸਕਦਾ ਜੀ ਸਾਡੇ ਘਰ ਤੱਕ ਕਿੰਨੇ ਵਜੇ ਤੱਕ ਸਾਨੂੰ ਟਾਇਮ ਮਿਲਜੂ ਜੀ ਸਾਡਾ ਜਿਹੜਾ ਆਡਰ ਨੰਬਰ ਹੈ ਜੀ ਉਹ ਸੱਤ ਅੱਠ ਛੇ ਨੌ ਇੱਕ ਹੈ ਜੀ ਠੀਕ ਹੈ ਜੀ ਠੀਕ ਹੈ ਥੈਂਕ ਯੂ ਜੀ